ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਮੈਂ ਨਾ ਤੁਹਾਡੇ ਇੱਕ ਤੁਹਾਡੀ ਮਦਦ ਚਾਹੀਦੀ ਸੀ ਮੈਂ ਨਾ ਤੁਹਾਡੇ ਗੁਆਂਡ 'ਚ ਜਿਹੜਾ ਸਿਫ਼ਟ ਹੋਈ ਆ ਅਤੇ ਮੈਨੂੰ ਨਾ ਇੱਕ ਮਦਦ ਚਾਹੀਦੀ ਸੀ ਕਿ ਮੈਂ ਨਾ ਆਪਣੀ ਗੱਡੀ ਦੀ ਨੰਬਰ ਪਲੇਟ ਚੇਂਜ ਕਰਾਉਣੀ ਸੀ ਤੁਹਾਨੂੰ ਪਤਾ ਬਾਹਰੋਂ ਆਓ ਤਾਂ ਉਹ ਪੁਲਿਸ ਵਾਲੇ ਬੜਾ ਤੰਗ ਕਰਦੇ ਹੈਗੇ ਆ ਤਾਂ ਉਹ ਨੰਬਰ ਪਲੇਟ ਚੇਂਜ ਕਰਾਉਣੀ ਤਾਂ ਉਹਦੇ ਰਿਗਾਰਡਿੰਗ ਮਦਦ ਚਾਹੀਦੀ ਸੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਓਕੇ ਜੀ ਥੈਂਕ